ਅਸੀਂ ਆਪਣੇ ਇਲਾਕੇ ਦੀਆਂ ਕਈ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਜਾਣਦੇ ਹਾਂ ਜਿਵੇਂ ਕਿ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਹਰਵਿੰਦਰ ਸਿੰਘ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਉਹਨਾਂ ਨੇ ਬਲਾਚੌਰ ਬਿਜਲੀ ਬੋਰਡ ਵਿੱਚ ਵੀ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਉਹਨਾਂ ਨੇ ਕਈ ਵਾਰ ਮੇਰੀ ਮਦਦ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਅਭਾਰੀ ਰਹਾਂਗਾ ਉਹਨਾਂ ਨੇ ਮੇਰੇ ਜ਼ਮੀਨੀ ਤੌਰ 'ਤੇ ਵੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਉਨਾਂ ਨੇ ਮੇਰਾ ਹਰ ਇੱਕ ਕੰਮ ਬਹੁਤ ਆਸਾਨੀ ਨਾਲ਼ ਕਰਵਾਇਆ ਹੈ ਅਤੇ ਬਾਕੀ ਕਾਂਗਰਸ ਪਾਰਟੀ ਦੇ ਨੇਤ ਨੇਤਾ ਨੇ ਸਾਨੂੰ ਕਈ ਵਾਰ ਮਦਦ ਕੀਤੀ ਹੈ ਅਤੇ ਕਾਂਗਰਸ ਪਾਰਟੀ ਵਿੱਚ ਸਾਡੇ ਕਈ ਤਰ੍ਹਾਂ ਦੇ ਘਰੇਲੂ ਕੰਮ ਵੀ ਕਰਵਾਏ ਗਏ ਹਨ